ਸਭ ਤੋਂ ਅਨਕਿਆਸੀ ਜਾਂ ਔਫ ਦਾ ਬੀਟ ਥਾਂ ਵਾਲੀ ਜਗ੍ਹਾ ਮੈਨੂੰ ਲੱਗੀ ਮਾਤਾ ਵੈਸ਼ਨੋ ਦੇਵੀ ਜੀ ਦੀ ਗੁਫ਼ਾ ਅਸੀਂ ਪਿਛਲੇ ਸਾਲ ਗਏ ਫਰਵਰੀ ਦੇ ਮਹੀਨੇ 'ਚ ਗਏ ਇਸ ਚੀਜ਼ ਨੂੰ ਖਾਸ ਬਣਾਇਆ ਉੱਥੋਂ ਦੇ ਮੌਸਮ ਨੇ ਅਤੇ ਪ੍ਰਾਕਿਰਤਿਕ ਗੁਫ਼ਾ ਨੇ ਫਰਵਰੀ 'ਚ ਤੁਹਾਨੂੰ ਪਤਾ ਸਭ ਬੱਚਿਆਂ ਦੇ ਪੇਪਰ ਹੁੰਦੇ ਆ ਉਸ ਟਾਈਮ ਰਸ਼ ਵੀ ਘੱਟ ਸੀ ਅਤੇ ਸ਼੍ਰਾਇਨ ਬੋਰਡ ਵਾਲਿਆਂ ਨੇ ਦੂਸਰੀ ਪੁਰਾਣੀ ਗੁਫ਼ਾ ਖੋਲੀ ਹੋਈ ਸੀ ਲੇਕਿਨ ਪੁਰਾਣੀ ਗੁਫ਼ਾ ਚੋਂ ਨਿਕਲ ਕੇ ਜੋ ਮਜ਼ਾ ਆਇਆ ਜੋ ਆਨੰਦ ਆਇਆ ਨਾ ਉਹ ਵਾਕਿਆ ਹੀ ਅਨਕਿਆਸੀ ਚੀਜ਼ ਹੈ ਮੇਰੀ ਜਿੰਦਗੀ 'ਚ ਇਸ ਤਰਾਂ ਲੱਗਦਾ ਸੀ ਕਿ ਜਿਸ ਤਰ੍ਹਾਂ ਸਵਰਗ 'ਚ ਹੀ ਆ ਗਏ ਹਾਂ ਮਤਲਬ ਉੱਥੋਂ ਦਾ ਮੌਸਮ ਉੱਥੋਂ ਦੀ ਬਰਫ਼ ਬਾਰੀ ਸਾਨੂੰ ਇਹ ਸੀ ਕਿ ਉਹ ਚੀਜ਼ ਦੇਖ ਕੇ ਉਹ ਪ੍ਰਾਕਿਰਤਿਕ ਗੁਫਾ ਦੇ ਦਰਸ਼ਨ ਕਰਕੇ ਬਿਲਕੁਲ ਵੀ ਥਕਾਵਟ ਨਹੀਂ ਹੋਈ ਇੱਥੋਂ ਜਾਣ ਲੱਗਿਆ ਅਸੀਂ ਸੋਚ ਕੇ ਗਏ ਸੀ ਕਿ ਭੈਰੋ ਘਾਟੀ ਦੀ ਅੱਗੋਂ ਅਸੀਂ ਘੋੜੇ 'ਤੇ ਜਾਵਾਂਗੇ ਲੇਕਿਨ ਐਸੇ ਦਰਸ਼ਨ ਐਸੀਆਂ ਜਗ੍ਹਾਂ ਦੇਖ ਕੇ ਐਸਾ ਕੁਦਰਤ ਦਾ ਨਜ਼ਾਰਾ ਦੇਖ ਕੇ ਸਾਨੂੰ ਥਕਾਵਟ ਵੀ ਭੁੱਲ ਗਈ ਅਤੇ ਅਸੀਂ ਦੇਖੋ ਪੈਦਲ ਹੀ ਯਾਤਰਾ ਕੀਤੀ ਭੈਰੋ ਘਾਟੀ ਵੀ ਭੈਰੋ ਘਾਟੀ ਅਸੀਂ ਪੈਦਲ ਗਏ ਉੱਥੇ ਹੋਰ ਮੌਸਮ ਦਾ ਆਨੰਦ ਇੰਝ ਲੱਗੇ ਕਿ ਜਿਸ ਤਰ੍ਹਾਂ ਅਸੀਂ ਬੱਦਲਾਂ ਵਿੱਚ ਹੀ ਚੱਲ ਰਹੇ ਹਾਂ ਉਹ ਚੀਜ਼ ਮਤਲਬ ਜ਼ਿੰਦਗੀ ਭਰ ਵਿੱਚ ਮੇਰੇ ਜ਼ਹਿਨ ਵਿੱਚ ਆ ਗਈ ਹੈ ਉਹਨੂੰ ਮੈਂ ਕਦੇ ਨਹੀਂ ਭੁੱਲ ਸਕਦੀ